ਵੀਹ ਗਿਆਰ੍ਹਾਂ ਉੱਨੀ ਸੌ ਸੱਤਰ ਸੋਲ੍ਹਾਂ ਨੌ ਦੋ ਹਜ਼ਾਰ ਅਠਾਰ੍ਹਾਂ ਗਿਆਰ੍ਹਾਂ ਅੱਠ ਦੋ ਹਜ਼ਾਰ ਚਾਰ ਇੱਕੀ ਸੱਤ ਉੱਨੀ ਸੌ ਉਣੱਤੀ ਗਿਆਰ੍ਹਾਂ ਦਸ ਉੱਨੀ ਸੌ ਸੰਤਾਲੀ